ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਅੱਛਾ ਜੀ ਇਹਦੇ ਵਿੱਚ ਐਂ ਹੁੰਦੇ ਆ ਕਾਕਾ ਜਦੋਂ ਆਪਾਂ ਕੋਈ ਕੰਮ ਕਰਦੇ ਆ ਨਾ ਪਹਿਲਾਂ ਲਗਨ ਚਾਹੀਦੀ ਹੈ ਕੰਮ ਕਰਨ ਦੀ ਇੱਛਾ ਹੋਵੇ ਆਪਾਂ ਨੂੰ ਫਿਰ ਉਹਦੇ ਪ੍ਰਤੀ ਪੂਰੀ ਇਮਾਨਦਾਰੀ ਚਾਹੀਦੀ ਹੈ ਠੀਕ ਹੈ ਉਸਦੇ ਬਾ ਇਸ ਤੋਂ ਬਾਅਦ ਜਦੋਂ ਬੰਦੇ ਦੇ ਮਨ ਦੇ ਸਭ ਚੀਜ਼ਾਂ ਪੂਰੀਆਂ ਹੋਈਆਂ ਜਦੋਂ ਆਪਾਂ ਕੰਮ ਆਪਾਂ ਸੱਚੀ ਲਗਨ ਨਾਲ ਕਰਦੇ ਆ ਨਾ ਉਹ ਅੱਗੇ ਦੀ ਅੱਗੇ ਆਪਾਂ ਨੂੰ ਬੈਨੀਫਿਟ ਦੇ ਕੇ ਜਾਵੇਗਾ ਪਹਿਲਾਂ ਮੇਰੇ ਦਾਦਾ ਜੀ ਕਰਦੇ ਸੀਗੇ ਮੇਰੇ ਦਾਦਾ ਜੀ ਤੋਂ ਮੈਂ ਦੇਖ ਦੇਖ ਕੇ ਮੈਨੂੰ ਪੂਰਾ ਸ਼ੌਂਕ ਲੱਗ ਗਿਆ ਬੇਟਾ ਮੇਰੀ ਧਿਆਨ ਨਾਲ ਗੱਲ ਸੁਣਨਾ ਦਾਦਾ ਜੀ ਕਰਦੇ ਸੀਗੇ ਉਹਨਾਂ ਨੂੰ ਦੇਖ ਦੇਖ ਕੇ ਮੈਂ ਸਿੱਖਿਆ ਉਹਨਾਂ ਤੋਂ ਇੱਕ ਦੋ ਚੀਜ਼ਾਂ ਮੈਂ ਪੁੱਛ ਲੈਂਦਾ ਸੀ ਕਿ ਦਾਦਾ ਜੀ ਤੁਸੀਂ ਇਹ ਐਂ ਕਿਉਂ ਕਰਦੇ ਹੋ ਕਿਉਂ ਕਰਦੇ ਹੋ ਉਹ ਕਹਿੰਦੇ ਬੇਟਾ ਜਿੰਨੀਆਂ ਆਪਾਂ ਦੇਸੀ ਚੀਜ਼ਾਂ ਦੀ ਵਰਤੋਂ ਕਰਾਂਗੇ ਉੱਨੀਆਂ ਵਧੀਆਂ ਹੀ ਚੀਜ਼ਾਂ ਆਪਾਂ ਨੂੰ ਮਿਲਣਗੀਆਂ ਉੱਨੀਆਂ ਹੀ ਚੰਗੀਆਂ ਚੀਜ਼ਾਂ ਉਹ ਆਪਣੀ ਸਿਹਤ ਲਈ ਚੰਗੀਆਂ ਰਹਿਣਗੀਆਂ ਮੈਂ ਉਹਨਾਂ ਦੀ ਸਿੱਖਿਆ ਪੂਰੇ ਮਨ 'ਚ ਲਈ ਮੈਂ ਉਹਨਾਂ ਦੀ ਦੱਸੋ ਬੇਟਾ ਜੀ ਜੀ ਇਹਦੇ ਵਿੱਚ ਤੁਸੀਂ ਪਹਿਲਾਂ ਐਂ ਦੱਸੋ ਰੇਹ ਸਪਰੇ ਅੰਗਰੇਜ਼ੀ ਦਵਾਈਆਂ ਕੀਟਨਾਸ਼ਕ ਵੀ ਵਰਤਦੇ ਹੋ ਤੁਸੀਂ ਬੇਟਾ ਨਹੀ ਨਹੀਂ ਨਹੀਂ ਬੇਟਾ ਉਹ ਤੁਸੀਂ ਬੰਦ ਕਰੋ ਪਹਿਲਾਂ ਤਾਂ ਜਿਹੜੀ ਆਪਾਂ ਨੇ ਉਪਜਾਊ ਮਿੱਟੀ ਆ ਉਹਨੂੰ ਆਪਾਂ ਦੋ ਦਿਨ ਪੋਲੀ ਕਰਕੇ ਛੱਡ ਦਿਓ ਠੀਕ ਆ ਫਿਰ ਉਸ ਵਿੱਚ ਆਪਣਾ ਦੇਸੀ ਗੋਬਰ ਨੂੰ ਮਿਕਸ ਕਰ ਦਿਓ ਜੋ ਵੀ ਬੀਜ ਤੁਸੀਂ ਬੀਜਣਾ ਗਾ ਉਹ ਸ਼ੁੱਧ ਕੀਤਾ ਹੋਇਆ ਲਓ ਨਹੀਂ ਉਹਨੂੰ ਤੁਸੀਂ ਦੋ ਦਿਨ ਦੁੱਧ ਵਿੱਚ ਭਿਉਂ ਕੇ ਰੱਖੋ ਉਸ ਤੋਂ ਬਾਅਦ ਤੁਸੀਂ ਲਾਓ ਅੰਗਰੇਜ਼ੀ ਦਵਾਈ ਤੁਸੀਂ ਬਿਲਕੁਲ ਵੀ ਨਹੀਂ ਛਿੜਕਾ ਕਰਨਾ ਉਹਦੇ ਵਿੱਚ ਤੁਸੀਂ ਦੇਸੀ ਜਿਵੇਂ ਆਪਾਂ ਰੂੜੀ ਦੀ ਰੇਹ ਲੈ ਲਓ ਪਾਣੀ 'ਚ ਜਿਵੇਂ ਆਪਣੀ ਪੰਜਾਬੀ 'ਚ ਕਹਿ ਦਿੰਦੇ ਆਪਾਂ ਪਾਥੀ ਨਹੀਂ ਹੁੰਦੀ ਉਹ ਪੰਜ ਲੀਟਰ 'ਚ ਇੱਕ ਪਾਥੀ ਸੁੱਟ ਦਿਓ ਅਤੇ ਉਹਦੇ ਵਿੱਚ ਪਾ ਦਿਓ ਤੁਸੀਂ ਘੱਟੋ ਘੱਟ ਅੱਧਾ ਲੀਟਰ ਲੱਸੀ ਪਾ ਦਿਓ ਅਤੇ ਦੋ ਕਿਲੋ ਆਪਣੇ ਨਿੰਮ ਦੇ ਪੱਤੇ ਲੈ ਕੇ ਪੰਜ ਲੀਟਰ ਪਾਣੀ 'ਚ ਉਹਨੂੰ ਰੱਖ ਦਿਓ ਫਿਰ ਉਹਨੂੰ ਕਈ ਦਿਨਾਂ ਨੂੰ ਇਹਨਾਂ ਨੂੰ ਰੱਖ ਦਿਓ ਢੱਕ ਕੇ ਕੋਈ ਕੋਈ ਚੀਜ਼ ਇਹ 'ਚ ਡਿੱਗੇ ਨਾ ਫਿਰ ਇਹਨਾਂ ਨੂੰ ਇਕੱਠੀਆਂ ਕਰਕੇ ਤੁਸੀਂ ਆਪਦੇ ਜੋ ਵੀ ਸਬਜ਼ੀ ਬੀਜੀ ਆ ਕੱਦੂ ਬੀਜਿਆ ਕੋਈ ਆਪਣੀ ਕੋਈ ਹੋਰ ਤੁਹਾਡੇ ਤੋਰੀ ਆ ਕਰੇਲਾ ਗਾ ਉਸ ਵਿੱਚ ਤੁਸੀਂ ਹਫਤੇ ਹਫਤੇ ਬਾਅਦ ਛਿੜਕਾ ਕਰੋ ਅਤੇ ਉਸ ਤੋਂ ਬਾਅਦ ਤੁਸੀਂ ਨਾਲੇ ਤਾਂ ਤੁਹਾਡੇ ਜੋ ਵੀ ਉਹ ਫ ਸਬਜ਼ੀ ਬੀਜੀ ਆ ਉਹਦੀ ਗਰੋਥ ਵਧੀਆ ਹੋਵੇਗੀ ਸਮਝੇ ਕਹਿਣ ਦਾ ਭਾਵ ਕਿ ਉਹਦਾ ਸਾਈਜ਼ ਵਧੀਆ ਹੋਵੇਗਾ ਅਤੇ ਦੂਸਰੀ ਗੱਲ ਕਿ ਟੇਸਟੀ ਇੰਨੀ ਚੀਜ਼ ਬਣੇਗੀ ਉਹ ਤੁਹਾਡੀ ਉਗਾਈ ਹੋਈ ਚੀਜ਼ ਤੁਹਾਨੂੰ ਯਾਨੀ ਕਿ ਹੋਰ ਖਾਣੇ ਭੁੱਲ ਜੂੰਗੇ ਹਾਂਜੀ ਹਾਂ ਕਰੋ ਬੇਟਾ ਜੇ ਮੇਰੀ ਜ਼ਰੂਰਤ ਹੋਈ ਜਦੋਂ ਮੈਨੂੰ ਕਾਲ ਕਰੋ ਮੈਂ ਤੁਹਾਡੀ ਸੇਵਾ 'ਚ ਹਾਜ਼ਰ ਹਾਂ ਠੀਕ ਹੈ ਜੀ